ਸਾਡੇ ਘਰ ਵਿੱਚ ਬਿਜਲੀ ਪੰਦਰਾਂ ਤੋਂ ਅਠਾਰਾਂ ਘੰਟੇ ਦੇ ਕਰੀਬ ਆਉਂਦੀ ਹੈ ਅਤੇ ਜੇ ਪੇਪਰਾਂ ਦੇ ਦਿਨਾਂ ਦੇ ਵਿੱਚ ਜੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਹਨ ਤਾਂ ਇਹ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਕਾਫੀ ਅਸਰ ਪੈਂਦਾ ਹੈਗਾ ਜੇ ਰਾਤ ਦਾ ਸਮਾਂ ਹੋਏਗਾ ਅਤੇ ਲਾਈਟ ਨਹੀਂ ਹੁੰਦੀ ਤਾਂ ਬੱਚੇ ਪੜ੍ਹ ਨਹੀਂ ਪਾਂਦੇ ਹਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਗਰਮੀਆਂ ਦੇ ਵਿੱਚ ਕਾਫੀ ਗਰਮੀ ਅਤੇ ਸਰਦੀਆਂ ਦੇ ਕੱਟ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਹੈਗਾ ਕਿ ਇਹ ਆਪਾਂ ਨੂੰ ਕੰਮ ਕਾਜ ਵਾਸਤੇ ਅਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਅਤੇ ਹੋਰ ਵੀ ਆਪਾਂ ਜੋ ਆਪਣੇ ਘਰ ਘਰੇਲੂ ਕੰਮ ਕਾਜ ਹੁੰਦੇ ਹਨ ਫੈਕਟਰੀਆਂ ਦੇ ਜਿਹੜੇ ਕੰਮਕਾਜ ਹੁੰਦੇ ਹਨ ਉਹਦੇ 'ਚ ਵੀ ਕਾਫੀ ਰੁਕਾਵਟ ਪੈਦਾ ਹੋ ਜਾਂਦੀ ਹੈਗੀ ਹੈ